ਸਿੱਖਿਆ ਸਿੱਖਿਆ ਲੋਕਾਂ ਦੀ ਅਗਵਾਈ ਕਰਨਾ ਆਸਾਨ ਬਣਾਉਂਦਾ ਹੈ ਸਿੱਖਿਆ ਤਰੱਕੀ ਅਤੇ ਸੰਚਾਰ ਦਾ ਸਾਧਨ ਹੈ ਸਿੱਖਿਆ ਇੱਕ ਗਿਆਨ ਸ਼ਕਤੀ ਹੈ ਡੁੰਘਾਈ ਨਾਲ ਹਰ ਚੰਗਾ ਅਧਿਆਪਕ ਸਿੱਖਿਆ ਦੇ ਪ੍ਰਭਾਵ ਅਤੇ ਮਹੱਤਵ ਨੂੰ ਜਾਣਦਾ ਹੈ ਇਹ ਸਿਰਫ ਸਕੂਲ ਵਿੱਚ ਪੜ੍ਹਨ ਲਿਖਣ ਬਾਰੇ ਨਹੀਂ ਹੈ ਇਹ ਇੱਕ ਸਹੀ ਸਿੱਖਿਆ ਲੋਕਾਂ ਨੂੰ ਵਿਅਕਤੀਗਤ ਅਤੇ ਸਮਾਜਿਕ ਤੌਰ 'ਤੇ ਵਿਕਾਸ ਕਰਨ ਲਈ ਸਹਿਤ ਕਰਦੀ ਹੈ ਸਿੱਖਿਆ ਇੱਕ ਵਿਅਕਤੀ ਨੂੰ ਪੜ੍ਹਾਉਣ ਨਾਲ ਹੀ ਉਹਨਾਂ ਨੂੰ ਲੀਡਰਸ਼ਿਪ ਦੀਆਂ ਭੂਮਿਕਾਵਾਂ ਨੂੰ ਅੱਗੇ ਵਧਾਉਣ ਲਈ ਪ੍ਰੇਰਿਤ ਕਰ ਸਕਦਾ ਹੈ ਅਤੇ ਉਹਨਾਂ ਦੇ ਆਲੇ ਦੁਆਲੇ ਦੇ ਲੋਕਾਂ 'ਤੇ ਸਕਾਰਾਤਮਕ ਪ੍ਰਭਾਵ ਪਾ ਸਕਦਾ ਹੈ ਸਿੱਖਿਆ ਸਾਨੂੰ ਇੱਕ ਬਿਹਤਰ ਜੀਵਨ ਜੀਣ ਦਾ ਤਰੀਕਾ ਦਿੰਦੀ ਹੈ ਤੁਸੀਂ ਸਹਾਇਕ ਹੋ ਕੇ ਆਪਣੇ ਭਰਾ ਨੂੰ ਉਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਪ੍ਰੇਰਿਤ ਕਰ ਸਕਦੇ ਹੋ ਮੈਂ ਆਪਣੇ ਭਰਾ ਨੂੰ ਇਹ ਕਹਿ ਕੇ ਪ੍ਰੇਰਿਤ ਕਰਦਾ ਹਾਂ ਕਿ ਉਸ ਨੂੰ ਚੁੱਪ ਰਹਿ ਕੇ ਮਿਹਨਤ ਕਰਨੀ ਚਾਹੀਦੀ ਹੈ ਅਤੇ ਉਸਦੀ ਕਾਮਯਾਬੀ ਸ਼ੋਰ ਮਚਾਏਗੀ ਅੱਜ ਕੱਲ੍ਹ ਦੇ ਜਵਾਕ ਬਾਰ੍ਹਵੀਂ ਕਰਕੇ ਜ਼ਿਆਦਾਤਰ ਬਾਹਰ ਵੱਲ ਰੁਝਾਨ ਕਰ ਰਹੇ ਹਨ ਪ੍ਰੰਤੂ ਇਸਦੇ ਉਲਟ ਮੈਂ ਆਪਣੇ ਭਰਾ ਨੂੰ ਉਚੇਰੀ ਸਿੱਖਿਆ ਸੀ ਏ ਦੀ ਤਿਆਰੀ ਕਰਵਾ ਰਿਹਾ ਹਾਂ ਤਾਂ ਜੋ ਉਹ ਪੜ੍ਹ ਲਿਖ ਕੇ ਇੱਥੇ ਨੌਕਰੀ ਲੱਗੇ ਅਤੇ ਆਪਣੇ ਦੇਸ਼ ਵਿੱਚ ਰਹਿ ਕੇ ਤਰੱਕੀ ਪ੍ਰਾਪਤ ਕਰੇ ਕਿਉਂਕਿ ਅੱਜ ਕੱਲ੍ਹ ਦੀ ਸਾਰੀ ਜਵਾਨੀ ਬਾਹਰ ਵੱਲ ਨੂੰ ਰੁਝਾਨ ਕਰਦੀ ਜਾ ਰਹੀ ਹੈ ਉਹਨਾਂ ਨੂੰ ਆਪਣੇ ਦੇਸ਼ ਵਿੱਚ ਰਹਿ ਕੇ ਕੰਮ ਕਰਨਾ ਬਿਲਕੁਲ ਵੀ ਪਸੰਦ ਨਹੀਂ ਉਹ ਦੂਜੇ ਦੇਸ਼ਾਂ ਵਿੱਚ ਜਾ ਕੇ ਕੰਮ ਕਰਦੇ ਹਨ ਮੈਂ ਚਾਹੁੰਦਾ ਹਾਂ ਕਿ ਮੇਰਾ ਭਰਾ ਇੱਥੇ ਹੀ ਪੜ੍ਹ ਲਿਖ ਕੇ ਤਰੱਕੀ ਪ੍ਰਾਪਤ ਕਰੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰੇ ਅਤੇ ਇਸ ਨੂੰ ਤਰੱਕੀ ਦੇ ਰਾਹ 'ਤੇ ਲੈ ਕੇ ਜਾਵੇ ਅਤੇ ਸਾਡੇ ਦੇਸ਼ ਵਿੱਚੋਂ ਕ੍ਰਪਸ਼ਨ ਅਤੇ ਰਿਸ਼ਵਤ ਨੂੰ ਖਤਮ ਕਰੇ ਮੈਂ ਆਪਣੇ ਭਰਾ ਨੂੰ ਇਹੀ ਕਹਿੰਦਾ ਹਾਂ ਕਿ ਸਫਲਤਾ ਉਦੋਂ ਵਧੀਆ ਹੁੰਦੀ ਹੈ ਜਦ ਉਸਨੂੰ ਮਨ ਲਗਾ ਕੇ ਕੀਤਾ ਜਾਵੇ ਸਿੱਖਿਆ ਸਾਨੂੰ ਹਮਦਰਦ ਵਿਅਕਤੀਗਤ ਅਤੇ ਸਾਡਾ ਆਤਮ ਵਿਸ਼ਵਾਸ ਪੈਦਾ ਕਰਨ ਵਿੱਚ ਮਦਦ ਕਰਦੀ ਹੈ